ਮੈਂ ਇੱਕ ਕਲਾਕਾਰ ਹਾਂ ਅਤੇ ਮੈਨੂੰ ਪੇਂਟਿੰਗ ਕਰਨਾ ਬਹੁਤ ਪਸੰਦ ਹੈ ਮੈਂ ਬਹੁਤ ਸਾਰੀ ਪੇਂਟਿੰਗਾਂ ਬਣਾਉਂਦਾ ਹਾਂ ਅਤੇ ਆਰਟ ਐਂਡ ਕ੍ਰਾਫਟ ਦਾ ਕੰਮ ਕਰਦਾ ਹਾਂ ਜਦੋਂ ਵੀ ਮੇਰੇ ਕਿਸੇ ਦੋਸਤ ਜਾਂ ਮੇਰੇ ਕਿਸੇ ਖਾਸ ਦਿਲ ਦੇ ਨੇੜੇ ਬੰਦੇ ਦਾ ਇ ਇਨਸਾਨ ਦਾ ਜਨਮਦਿਨ ਹੋਵੇ ਜਾਂ ਕੁਝ ਐਨਵਰਸਰੀ ਹੋਵੇ ਜਾਂ ਕਿਸੇ ਦਾ ਵਿਆਹ ਹੋਵੇ ਤਾਂ ਮੈਂ ਉਸਨੂੰ ਹਮੇਸ਼ਾਂ ਆਪਣੇ ਹੱਥ ਨਾਲ ਬਣਾਏ ਕਾਰਡ ਜਾਂ ਆਪਣੇ ਹੱਥ ਨਾਲ ਬਣਾਈ ਆਪਣੀ ਮਿਹਨਤ ਦੀ ਪੇਂਟਿੰਗ ਉਸ ਨੂੰ ਗਿਫਟ ਦੇ ਰੂਪ ਵਿੱਚ ਦਿੰਦਾ ਹਾਂ ਉਸਨੂੰ ਉਪਹਾਰ ਦਿੰਦਾ ਹਾਂ ਤਾਂ ਜੋ ਉਹ ਇਹ ਗੱਲ ਹਮੇਸ਼ਾਂ ਯਾਦ ਰੱਖੇ ਕਿ ਉਸ ਨੂੰ ਕਿਸੇ ਨੇ ਇੱਕ ਇੰਨਾਂ ਸੋਹਣਾ ਉਪਹਾਰ ਦਿੱਤਾ ਸੀ ਹਮੇਸ਼ਾਂ ਆਪੇ ਬਣਾਈਆਂ ਚੀਜ਼ਾਂ ਦਾ ਜ਼ਿਆਦਾ ਭਾਵਨਾਤਮ ਮੁੱਲ ਹੁੰਦਾ ਹੈ ਕਿਉਂਕਿ ਉਹਨਾਂ ਚੀਜ਼ਾਂ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਅਤੇ ਉਹ ਬੰਦਾ ਇਹ ਦਿਨ ਰਾਤ ਇੱਕ ਕਰਕੇ ਬਣਾਉਂਦਾ ਹੈ ਇਸ ਵਿੱਚ ਪਿਆਰ ਹਲੀਮੀ ਅਤੇ ਮਿਹਨਤ ਦੇ ਨਾਲ ਨਾਲ ਇਨਸਾਨ ਆਪਣਾ ਕਈ ਸਾਲਾਂ ਦਾ ਤਜ਼ੁਰਬਾ ਲਗਾ ਕੇ ਬਣਾਉਂਦਾ ਹੈ ਬਹੁਤ ਸਾਰੇ ਕਾਰਡ ਪੇਂਟਿੰਗਾਂ ਆਮ ਵਿਕਾਰੂ ਵੀਜਾਊ ਵੀ ਹੁੰਦੀਆਂ ਹਨ ਪਰ ਜਿਹੜੇ ਬੰਦਾ ਇਨਸਾਨ ਖੁਦ ਬਣਾ ਕੇ ਦਿੰਦਾ ਹੈ ਉਸ ਦੀ ਗੱਲ ਅਲੱਗ ਹੈ ਕਿਉਂਕਿ ਉਹ ਬਹੁਤ ਹੀ ਸੋਹਣੀ ਅਤੇ ਦਿਲ ਦੇ ਨਾਲ ਰਹਿਣ ਵਾਲੀ ਪੇਂਟਿੰਗ ਹੁੰਦੀ ਹੈ ਜਿਵੇਂ ਕਿ ਮੈਂ ਇੱਕ ਉਦਾਹਰਨ ਦਿੰਦਾ ਪਿੱਛੇ ਇੱਕ ਮਹੀਨਾ ਪਹਿਲੇ ਮੇਰੇ ਭਰਾ ਦਾ ਵਿਆਹ ਸੀ ਉਸ ਨੂੰ ਮੈਂ ਉਸ ਦਾ ਬਣਾਇਆ ਪੋਰਟਰੇਟ ਦਿੱਤਾ ਸੀ ਉਹ ਪੋਟਰੇਟ ਵਿੱਚ ਮੈਂ ਉਹਨਾਂ ਦਾ ਚਿਹਰਾ ਅਤੇ ਉਹਨਾਂ ਦੀ ਘਰਦੀ ਦਾ ਚਿਹਰਾ ਬਣਾਇਆ ਸੀ ਜਦੋਂ ਮੈਂ ਉਹਨਾਂ ਨੂੰ ਗਿਫ਼ਟ ਦਿੱਤਾ ਉਹ ਬਹੁਤ ਖੁਸ਼ ਹੋਏ ਉਹਨਾਂ ਨੂੰ ਅਜਿਹਾ ਕਿਸੇ ਨੇ ਪਹਿਲੀ ਵਾਰ ਦਿੱਤਾ ਸੀ ਅਤੇ ਉਹ ਉਪਹਾਰ ਉਹ ਹਮੇਸ਼ਾਂ ਨਹੀਂ ਭੁੱਲਣਗੇ ਕਿਉਂਕਿ ਉਸ ਉਪਹਾਰ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗੀ ਹੈ ਅਤੇ ਉਹ ਬਹੁਤ ਅਲੱਗ ਲੱਗਦਾ ਹੈ ਇਸ ਕਰਕੇ ਹਮੇਸ਼ਾਂ ਕੋਸ਼ਿਸ਼ ਕਰੋ ਕਿ ਸਾਨੂੰ ਹਮੇਸ਼ਾਂ ਆਪਣੇ ਹੱਥੀਂ ਬਣਾਈ ਚੀਜ਼ਾਂ ਦਾ ਤੋਹਫਾ ਦੇਣਾ ਚਾਹੀਦਾ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਭਾਵਨਾਤਮਕ ਲੱਗਦੇ ਹਨ ਅਤੇ ਬਹੁਤ ਚੰਗੇ ਵੀ ਲੱਗਦੇ ਹਨ